ਸਾਡੇ ਪੰਜਾਬ ਦੇ ਵਿੱਚ ਤਿੰਨ ਮੁੱਖ ਸਿਆਸੀ ਪਾਰਟੀਆਂ ਹਨ ਜਿਹਨਾਂ ਵਿੱਚ ਇੱਕ ਸਿਆਸੀ ਪਾਰਟੀ ਹੈ ਜਿਹੜੀ ਕਿ ਹੈ ਤੱਕੜੀ ਤੱਕੜੀ ਦੇ ਵਿੱਚ ਸਾਡੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੀ ਸਿਆਸਤਦਾਨ ਰਹੇ ਸਨ ਬਟ ਹੁਣ ਸੁਖਬੀਰ ਬਾਦਲ ਜੀ ਇਹਦੇ ਵਿੱਚ ਸਿਆਸਤਦਾਨ ਹਨ ਅਤੇ ਦੂਸਰੀ ਪਾਰਟੀ ਹੈ ਸਾਡੀ ਆਮ ਆਦਮੀ ਪਾਰਟੀ ਝਾੜੂ ਝਾੜੂ ਦੇ ਵਿੱਚ ਸਾਡੇ ਕੀ ਕੇਜਰੀਵਾਲ ਹਨ ਕੇਜਰੀਵਾਲ ਜੀ ਅਤੇ ਇਹ ਸਾਡਾ ਸਾਡੇ ਸਾਰੇ ਹੀ ਕੰਮ ਕਰਨ ਦੇ ਵਿੱਚ ਹੈਲਪ ਹਨ ਤੀਜਾ ਹੈਗਾ ਸਾਡੇ ਕਾਂਗਰਸ ਕਾਂਗਰਸ ਦੇ ਵਿੱਚ ਸਾਡਾ ਚੋਣ ਨਿਸ਼ਾਨ ਹੈ ਪੰਜਾ ਪੰਜੇ ਦੇ ਵਿੱਚ ਕੀ ਹੈ ਕਿ ਬਹੁਤ ਸਾਰੀ ਇਹ ਵੀ ਕੰਮ ਕਰਦੇ ਹਨ ਇਹਦੇ ਵਿੱਚ ਪਹਿਲਾ ਹੈ ਰਾਹੁਲ ਗਾਂਧੀ ਰਾਹੁਲ ਗਾਂਧੀ ਅਤੇ ਇਨਦੇ ਸਿਆਸਤਦਾਨ ਹਨ ਸੋਨੀਆ ਗਾਂਧੀ ਪਹਿਲਾਂ ਸੀਗੀ ਇੰਦਰਾ ਗਾਂਧੀ ਇਸ ਕਰਕੇ ਹੀ ਇਹ ਸਾਰੇ ਸਾਡੇ ਸਿਆਸੀ ਪਾਰਟੀਆਂ ਪੰਜਾਬ ਦਾ ਵਿਕਾਸ ਕਰਨ ਦੇ ਵਿੱਚ ਬਹੁਤ ਮਦਦ ਕਰ ਰਹੀਆਂ ਹਨ ਅਤੇ ਇਹ ਪੰਜਾਬ ਦਾ ਵਿਕਾਸ ਬਹੁਤ ਹੀ ਸਰਵ ਪੱਖੀ ਢੰਗ ਨਾਲ ਕਰ ਰਹੀਆਂ ਹਨ ਤਿੰਨੋਂ ਪਾਰਟੀਆਂ ਹੀ ਵਧੀਆ ਹਨ ਅਤੇ ਤਿੰਨੋਂ ਪਾਰਟੀਆਂ ਹੀ ਵਿਕਾਸ ਕਰਨ ਦੇ ਵਿੱਚ ਇੱਕ ਦੂਜੇ ਤੋਂ ਵੀ ਅੱਗੇ ਹਨ ਇਹ ਤਿੰਨੋ ਪਾਰਟੀਆਂ ਨੂੰ ਸਭ ਇੱਕ ਇੱਕ ਕਰਕੇ ਕੰਮ ਕੀਤੇ ਜਾਂਦੇ ਹਨ ਅਤੇ ਪਹਿਲਾ ਕੀ ਹੈ ਤੱਕੜੀ ਤੱਕੜੀ ਤਾਂ ਪੰਜਾਬ ਦੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਹੈ ਅਤੇ ਉਸ ਤੋਂ ਬਾਅਦ ਕਾਂਗਰਸ ਕਾਂਗਰਸ ਦਾ ਵੀ ਬਹੁਤ ਹੈ ਅਤੇ ਝਾੜੂ ਅੱਜ ਕੱਲ੍ਹ